ਖੇਡਣ ਦੇ ਨਾਲ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਸਾਡੇ ਸਾਹ ਦੇ ਰੋਗ ਜਿਹੜੇ ਨੇ ਉਹ ਦੂਰ ਰਹਿੰਦੇ ਨੇ ਔਰ ਸਾਡੇ ਸਰੀਰ ਦੇ ਵਿੱਚ ਜਿਹੜੀ ਆ ਤੰਦਰੁਸਤੀ ਬਣੀ ਰਹਿੰਦੀ ਆ ਔਰ ਫੁਰਤੀ ਆਉਂਦੀ ਹੈ ਸਾਡੇ ਸਰੀਰ ਦੇ ਵਿੱਚ ਸਾਡਾ ਸਰੀਰ ਜਿਹੜਾ ਆ ਉਹ ਲਚਕੀਲਾ ਹੁੰਦਾ ਆ ਇਸ ਤੋਂ ਇਲਾਵਾ ਬਹੁਤ ਸਾਰੇ ਢੰਗ ਨੇ ਜਿਹਨਾਂ ਦੇ ਨਾਲ ਖੇਡਾਂ ਲੋਕਾਂ ਦੇ ਜੀਵਨ ਦੀ ਸਮੁੱਚੀ ਗੁਣਵੱਤਾ ਅਤੇ ਪੋਜੀਟਿਵ ਪ੍ਰਭਾਵ ਪਾਉਂਦੀਆਂ ਨੇ ਉਹ ਤਰੀਕੇ ਇਹ ਨੇ ਕਿ ਲੋਕ ਅਲੱਗ ਅਲੱਗ ਟੂਰਨਾਮੈਂਟਸ ਕਰਵਾਉਂਦੇ ਨੇ ਅਤੇ ਉਹਨਾਂ ਦੇ ਵਿੱਚ ਜਿਹੜੇ ਆ ਪੈਸੇ ਲਗਾ ਕੇ ਇਨਾਮ ਰੱਖੇ ਜਾਂਦੇ ਨੇ ਔਰ ਜੋ ਉਸ ਟੂਰਨਾਮੈਂਟ ਨੂੰ ਜਿੱਤਦਾ ਆ ਜਿਹੜੀ ਟੀਮ ਉਸ ਟੂਰਨਾਮੈਂਟ ਨੂੰ ਜਿੱਤਦੀ ਆ ਉਸਨੂੰ ਉਹ ਇਨਾਮ ਜਿਹੜਾ ਆ ਉਹ ਰਾਸ਼ੀ ਜਿਹੜੀ ਆ ਇਨਾਮ ਵੱਜੋਂ ਦਿੱਤੀ ਜਾਂਦੀ ਆ ਸੋ ਇਹਨਾਂ ਤਰੀਕਿਆਂ ਦੇ ਨਾਲ ਜਿਹੜਾ ਆ ਲੋਕਾਂ 'ਤੇ ਇੱਕ ਪੋਜੀਟਿਵ ਪ੍ਰਭਾਵ ਪੈਂਦਾ ਆ ਲੋਕ ਬਿਮਾਰੀਆਂ ਤੋਂ ਬਚੇ ਰਹਿੰਦੇ ਨੇ ਲੋਕਾਂ ਦੇ ਸਰੀਰ ਦੇ ਵਿੱਚ ਲਚਕੀਲਾਪਨ ਆਉਂਦਾ ਆ ਔਰ ਉਹ ਆਪਣੀ ਕਮਾਈ ਦਾ ਵੀ ਇੱਕ ਸਾਧਨ ਜਿਹੜਾ ਆ ਉਹ ਬਣਾ ਸਕਦੇ ਨੇ ਖੇਡਾਂ ਨੂੰ